ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਮੈਂ ਪਿੰਡ ਟੱਪਰੀਆਂ ਦਾ ਰਹਿਣ ਵਾਲਾ ਏ ਜੀ ਹਾਂਜੀ ਲਾਸਟ ਵੀਕ ਨਾ ਜੀ ਮੈਂ ਇੱਕ ਫ਼ੋਨ ਲਿਆ ਤਾ ਜੀ ਜੋ ਕਿ ਐਪਲ ਵਾਲਿਆਂ ਦਾ ਏ ਆਈ ਫ਼ੋਨ ਚੌਦਾਂ ਪ੍ਰੋ ਜੀ ਮੈਂ ਬੌਟ ਕਰਿਆ ਅਤੇ ਮੈਨੂੰ ਬਹੁਤ ਹੀ ਵਧੀਆ ਐਕਪੀਰੀਅਂਸ ਲੱਗਿਆ ਉਹਦਾ ਅਤੇ ਮੈਂ ਉਹ ਫ਼ੋਨ ਇੱਕ ਲੱਖ ਬਹੱਤਰ ਹਜ਼ਾਰ ਦਾ ਲਿਆ ਸੀ ਜਿਸ ਵਿੱਚ ਕਿ ਬਹੁਤ ਸਾਰੇ ਫੀਚਰ ਹਨ ਜੋ ਕਿ ਮੇਰੇ ਬਹੁਤ ਹੀ ਕੰਮ ਆਉਂਦਾ ਹੈ ਜਿਵੇਂ ਕਿ ਮੈਂ ਦਫ਼ਤਰ ਦਾ ਕੰਮ ਵੀ ਉਸ 'ਤੇ ਹੀ ਕਰਦਾ ਹਾਂ ਅਤੇ ਹੋਰ ਵੀ ਮੇਰਾ ਫਰੀ ਟਾਈਮ ਪਾਸ ਕਰਨ ਦੇ ਵਿੱਚ ਵੀ ਮੇਰੇ ਕੰਮ ਆਉਂਦਾ ਹੈ ਜਿਵੇਂ ਕਿ ਮੈਂ ਉਸ ਤੇ ਗੇਮਾਂ ਵੀ ਖੇਲਦਾ ਹਾਂ ਅਤੇ ਹੋਰ ਵੀ ਮੈਂ ਉਸਦੇ ਬਹੁਤ ਫਾਇਦੇ ਲੈਂਦਾ ਹਾਂ ਜਿਵੇਂ ਕਿ ਉਹ ਮੇਰੇ ਬੁੱਕ ਰੀਡਿੰਗ ਕਰਨ ਦੇ ਵੀ ਬਹੁਤ ਕੰਮ ਆਉਂਦਾ ਹੈ ਅਤੇ ਫ਼ੋਨ ਦੇ ਬਹੁਤ ਹੀ ਫਾਇਦੇ ਹਨ ਜਿਵੇਂ ਕਿ ਮੈਂ ਕਿਤੇ ਆਊਟ ਆਫ ਸਟੇਸ਼ਨ ਗਿਆ ਵਾ ਹੁੰਨਾ ਏ ਅਤੇ ਮੈਂ ਆਪਣੇ ਫਰੈਂਡਜ਼ ਅਤੇ ਫੈਮਿਲੀ ਨਾਲ਼ ਗੱਲ ਕਰ ਸਕਦਾ ਹਾਂ ਜਿਹਦੇ 'ਚ ਕਿ ਮੈਂ ਉਹਨਾਂ ਨੂੰ ਦੱਸ ਸਕਦਾ ਵੀ ਹਾਂ ਮੈਂ ਠੀਕ ਹੈ ਵੀ ਜਾਂ ਮੈਂ ਕਿੱਦਣ ਘਰੇ ਆਉਣਾ ਏ ਅਤੇ ਫ਼ੋਨ ਬਹੁਤ ਵਧੀਆ ਚੀਜ਼ ਹੈ ਜੀ ਇਹ ਹਰ ਇੱਕ ਬੰਦੇ ਨੂੰ ਰੱਖਣਾ ਚਾਹੀਦਾ ਏ ਥੈਂਕ ਯੂ ਜੀ